ਡਾਂਸ ਵੀ ਤਿਉਹਾਰ ਜਾਂ ਸਮਾਗਮ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ ਜਦੋਂ ਸਾਡੇ ਕੋਈ ਵੀ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਜਾਂ ਕੋਈ ਵੀ ਸਮਾਗਮ ਹੁੰਦਾ ਹੈ ਜਿਵੇਂ ਵਿਆਹ ਸ਼ਾਦੀ ਜਾਂ ਵਿਸਾਖੀ ਲੋਹੜੀ ਅਤੇ ਹੋਲੀ ਆਦਿ ਦੇ ਤਿਉਹਾਰ ਅਤੇ ਇਹ ਡਾਂਸ ਬਹੁਤ ਭੂਮਿਕਾ ਨਿਭਾਉਂਦਾ ਹੈ ਅਤੇ ਲੋਕ ਨੱਚਦੇ ਟੱਪਦੇ ਹਨ ਅਤੇ ਵਿਆਹ ਦੇ ਮੌਕੇ 'ਤੇ ਜਦੋਂ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਤਾਂ ਉਦੋਂ ਡਾਂਸ ਕਰਦੇ ਹਨ ਅਤੇ ਡਾਂਸ ਇਹ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਡਾਂਸ ਕਰਦੇ ਹਨ ਜਿਹੜੇ ਦਿਨ ਤਿਉਹਾਰ ਹਨ ਇਹ ਡਾਂਸ ਬਿਨਾ ਅਧੂਰੇ ਹੁ ਰਹਿੰਦੇ ਹਨ ਅਤੇ ਜਦੋਂ ਇਹ ਜਦੋਂ ਅਸੀਂ ਨੱਚਦੇ ਹਾਂ ਅਤੇ ਇਹ ਤਿਉਹਾਰ ਬਹੁਤ ਚੰਗਾ ਮਨਾਇਆ ਜਾਂਦਾ ਹੈ ਅਤੇ ਜਿਸ ਕਾਰਨ ਵੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਡਾਂਸ ਹਨ ਇਹ ਬਹੁਤ ਅਹਿਮ ਭੂਮਿਕਾ ਹੈ ਇਹਨਾਂ ਦੀ ਅਤੇ ਕੋਈ ਵੀ ਦਿਨ ਤਿਉਹਾਰ ਆਉਂਦਾ ਹੈ ਅਤੇ ਇਹਨਾਂ ਵਿੱਚ ਵੀ ਡਾਂਸ ਕੀਤਾ ਜਾਂਦਾ ਹੈ ਅਤੇ ਇਸ ਕਰਕੇ ਹੀ ਇਹ ਸਮਾਗਮ ਇਹ ਬਹੁਤ ਚੰਗੇ ਮਨਾਏ ਜਾਂਦੇ ਹਨ ਅਤੇ ਸਾਨੂੰ ਬਹੁਤ ਖੁਸ਼ੀ ਪ੍ਰਦਾਨ ਕਰਦੇ ਹਨ